ਸਤਿ ਸ਼੍ਰੀ ਅਕਾਲ ਸਰ ਹਾਂਜੀ ਸਰ ਕੀ ਮੈਂ ਉਬਰ ਕੰਪਨੀ ਦੇ ਮੈਨੇਜਰ ਨਾਲ ਗੱਲ ਕਰ ਰਹੀ ਹਾਂ ਹਾਂਜੀ ਸਰ ਮੈਨੂੰ ਅਸਲ 'ਚ ਇੱਕ ਕੈਬ ਬੁੱਕ ਕਰਵਾਉਣੀ ਸੀ ਹਾਂਜੀ ਸਰ ਤੁਹਾਡੇ ਵੱਡੀ ਗੱਡੀ ਦੀ ਅਤੇ ਛੋਟੀ ਗੱਡੀ ਦੀ ਕੀ ਪ੍ਰਾਈਜਿਸ ਹੈ ਇੱਕ ਤੋਂ ਦੋ ਛੋਟੀ ਦੀ ਅਤੇ ਪੰਜ ਚੋਂ ਅੱਠ ਵੱਡੀ ਦੀ ਹਾਂਜੀ ਸਰ ਕਿਉਂਕਿ ਆਪਾਂ ਚਾਰ ਤੋਂ ਪੰਜ ਪੰਜ ਜਣੇ ਆ ਅਤੇ ਕਿਉਂਕਿ ਸਾਡਾ ਲਗਿਜ਼ ਵੀ ਜ਼ਿਆਦਾ ਤਾਂ ਪਲੀਜ਼ ਤੁਸੀਂ ਸਾਨੂੰ ਵੱਡੀ ਗੱਡੀ ਬੁੱਕ ਕਰ ਸਕਦੇ ਹੋ ਹਾਂਜੀ ਸਰ ਅਸਲ 'ਚ ਮੇਰੀ ਇਕੱਤੀ ਤਿੰਨ ਦੋ ਹਜ਼ਾਰ ਚੌਵੀ ਦੀ ਸਵੇਰ ਦੀ ਫਲਾਈਟ ਹੈ ਮੈਨੂੰ ਅੱਠ ਵਜੇ ਦੀ ਟਾਈਮਿੰਗ ਪਰਟੀਕੁਲਰ ਟਾਈਮਿੰਗ ਹੈ ਜਿਹੜੀ ਇਹ ਮੇਰੀ ਅੱਠ ਵਜੇ ਦੀ ਹੈ ਜਿਹੜੀ ਕਿ ਇੱਥੋਂ ਗੁਰਦਾਸਪੁਰ ਤੋਂ ਅੰਮ੍ਰਿਤਸਰ ਲੋਕੇਸ਼ਨ ਹੈ ਜਿਹੜੀ ਜਾਣ ਦੀ ਹੈ ਹਾਂਜੀ ਸਰ ਹਾਂਜੀ ਸਰ ਕੀ ਤੁਸੀਂ ਮੈਨੂੰ ਉੱਥੋਂ ਦੀ ਕੈਬ ਵਾਸਤੇ ਕਰ ਸਕਦੇ ਹੋ ਕੈਬ ਬੁੱਕ ਕਰ ਸਕਦੇ ਹੋ ਹਾਂਜੀ ਸਰ ਹਾਂਜੀ ਸਰ ਓਕੇ ਸਰ ਠੀਕ ਹੈ ਸਰ ਹਾਂਜੀ ਸਰ ਧੰਨਵਾਦ ਸਰ ਹਾਂਜੀ ਸਰ